ਸ਼ੌਂਕ ਵਜੋਂ ਫੋਟੋਗ੍ਰਾਫੀ ਜਾਰੀ ਰੱਖਣ ਦੀ ਮੇਰੇ ਵੱਲੋਂ ਇਹ ਪ੍ਰੇਰਨਾ ਹੈ ਕੀ ਫੋਟੋਗ੍ਰਾਫੀ ਕਰਨ ਨਾਲ ਸਾਨੂੰ ਆਪਣੇ ਆਪ ਦਾ ਪਤਾ ਲੱਗਦਾ ਹੈ ਫੋਟੋਆਂ ਦੇ ਦੁਆਰਾ ਸਾਨੂੰ ਆਪਣੀ ਦਿੱਖ ਦਾ ਪਤਾ ਲੱਗਦਾ ਹੈ ਅਤੇ ਅਸੀਂ ਆਪਣੇ ਬਾਰੇ ਬਹੁਤ ਕੁਛ ਜਾਣ ਜਾਂਦੇ ਆ ਫੋਟੋਗ੍ਰਾਫੀ ਜਾਰੀ ਰੱਖਣਾ ਉਨਾਂ ਲੋਕਾਂ ਲਈ ਬਹੁਤ ਜ਼ਰੂਰੀ ਹੈ ਜਿਹਨਾਂ ਨੂੰ ਫੋਟੋਗ੍ਰਾਫੀ ਵਿੱਚ ਬਹੁਤ ਸ਼ੌਂਕ ਹੈ ਇਸ ਦੇ ਨਾਲ ਉਹ ਆਪਣੀ ਸ਼ਖਸੀਅਤ ਨੂੰ ਬਹੁਤ ਚੰਗਾ ਬਣਾ ਸਕਦੇ ਹਨ